ਇਹ ਮੇਰਾ ਫੇਵਰੇਟ ਟੋਪਿਕ ਹੈ ਕਿ ਆਪਾਂ ਕਿਹੜੇ ਆਸਨ ਕਰਕੇ ਲਚਕਤਾ ਵਧਾ ਸਕਦੇ ਹਾਂ ਅਤੇ ਮੈਂ ਦੱਸ ਦੇਵਾਂ ਕਿ ਯੋਗ ਆਸਨ ਜਿੰਨੇ ਵੀ ਨੇ ਸਭ ਤੁਹਾਡੇ ਬਾਡੀ ਦੇ ਲਈ ਬਹੁਤ ਵਧੀਆ ਨੇ ਤੁਹਾਡੇ ਸਰੀਰ ਨੂੰ ਲਚਕ ਹੀ ਦਿੰਦੇ ਨੇ ਲੇਕਿਨ ਅਗਰ ਤੁਸੀਂ ਕਿਸੇ ਸਭ ਤੋਂ ਬੈਸਟ ਆਸਨ ਦੀ ਗੱਲ ਕਰੇ ਤਾਂ ਸੂਰਿਆ ਨਮਸਕਾਰ ਤੋਂ ਵੱਧ ਵਧੀਆ ਕੋਈ ਵੀ ਆਸਨ ਇੱਦਾਂ ਦਾ ਨਹੀਂ ਹੈ ਜੋ ਤੁਹਾਨੂੰ ਜ਼ਿਆਦਾ ਲਚਕ ਦੇਵੇ ਸੂਰਿਆ ਆਸਨ ਦੇ ਬਾਰਾਂ ਜੋ ਸਟੈਪ ਨੇ ਉਹਦੇ ਵਿੱਚ ਹੀ ਸਾਰੇ ਆਸਨ ਜੋ ਹੈਗੇ ਨੇ ਪੂਰੇ ਹੋ ਜਾਂਦੇ ਨੇ ਤੁਸੀਂ ਅਗਰ ਰੋਜ਼ਾਨਾ ਪੰਜ ਵਾਰੀ ਵੀ ਸੂਰਿਆ ਨਮਸਕਾਰ ਕਰਦੇ ਹੋ ਤਾਂ ਤੁਹਾਡੀ ਬਾਡੀ ਇੰਨੀ ਐਕਟਿਵ ਹੋ ਜਾਵੇਗੀ ਵੀ ਤੁਸੀਂ ਆਪਣੇ ਆਪ ਨੂੰ ਈ ਜਵਾਨ ਹੀ ਰੱਖ ਪਾਓਗੇ ਲੰਬੇ ਸਮੇਂ ਦੇ ਲਈ ਅਤੇ ਅਗਰ ਅਸੀਂ ਸੂਰਿਆ ਨਮਸਕਾਰ ਤੋਂ ਵ ਬਾਅਦ ਵਿੱਚ ਗੱਲ ਕਰੀਏ ਤਾਂ ਤੁਸੀਂ ਹਲ ਆਸਨ ਸਰਵਾਂਗ ਆਸਨ ਭੁਜੰਗ ਆਸਨ ਜਿਹਨੂੰ ਆਪਾਂ ਸਨੇਕ ਪੋਜ਼ ਕਹਿੰਦੇ ਹਾਂ ਬ੍ਰਿਜ ਆਸਨ ਕਰ ਸਕਦੇ ਹਾਂ ਇਹ ਵੀ ਲਚਕਤਾ ਹੀ ਵਧਾਉਂਦੇ ਹਨ ਔਰ ਜਿਹਨਾਂ ਨੂੰ ਹਮੇਸ਼ਾ ਪੇਟ ਵਿੱਚ ਗੈਸ ਜਾਂ ਫਿਰ ਐਸੀਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਉਹ ਪਵਨ ਮੁਕਤ ਆਸਨ ਕਰ ਸਕਦੇ ਨੇ ਹਲ ਆਸਨ ਉਹਨਾਂ ਲਈ ਵਧੀਆ ਹੈ ਜਿਹਨਾਂ ਦੇ ਪੇਟ ਵਿੱਚ ਜਿੱਦੀ ਚਰਬੀ ਅ ਜੋ ਹੈ ਉਹ ਜੰਮੀ ਹੋਈ ਹੈ ਉਹਨੂੰ ਚਰਬੀ ਨੂੰ ਹਟਾਉਣ ਦੇ ਲਈ ਰੈਗੂਲਰ ਜੋ ਹੈ ਤੁਸੀਂ ਹਲ ਆਸਨ ਕਰ ਸਕਦੇ ਹਾਂ ਸਰਵਾਂਗ ਆਸਨ ਤੁਹਾਡੀ ਸਕਿੰਨ ਲਈ ਤੁਹਾਡੇ ਵਾਲਾਂ ਲਈ ਬਹੁਤ ਵਧੀਆ ਕਿਉਂਕਿ ਜੋ ਬਲੱਡ ਫਲੋ ਹੈਗਾ ਉਹ ਸਾਰਾ ਸਿਰ ਦੇ ਤਰਫ ਹੋ ਜਾਂਦਾ ਕਿਉਂਕਿ ਅਸੀਂ ਲੱਤਾਂ ਉੱਪਰ ਨੂੰ ਚੱਕ ਕੇ ਸਰਵਾਂਗ ਆਸਨ ਕਰਦੇ ਹਾਂ ਜਿਹਦੇ ਨਾਲ ਕੀ ਹੁੰਦਾ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਹੋ ਜਾਂਦੀ ਹੈ ਭੁਜੰਗ ਆਸਨ ਲੀਵਰ ਫੇਫੜਿਆਂ ਲਈ ਬਹੁਤ ਵਧੀਆ ਅਤੇ ਇਹ ਪੇਟ ਦੀ ਚਰਬੀ ਇਹਦੇ ਨਾਲ ਜੋ ਹੈ ਘੱਟ ਹੁੰਦੀ ਹੈ ਜਦੋਂ ਸਾਡੇ ਫੇਫੜਿਆਂ ਨੂੰ ਪੂਰੇ ਤਰੀਕੇ ਨਾਲ ਆਕਸੀਜਨ ਮਿਲਦੀ ਹੈ ਨਾ ਅਤੇ ਆਪਣੇ ਆਪ ਹੀ ਸਕਿੰਨ ਸਾਡੀ ਸਾਫ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨਾਂ ਲੋਕਾਂ ਨੂੰ ਸਕਿੰਨ ਦੀ ਪ੍ਰੋਬਲਮ ਹੈ ਉਹ ਭੁਜੰਗ ਆਸਨ ਕਰ ਸਕਦੇ ਆ ਲਚਕਤਾ ਦੀ ਜੇ ਗੱਲ ਕਰੀਏ ਤਾਂ ਸਰ ਸਰਵਾਂਗ ਆਸਨ ਹਲ ਆਸਨ ਭੁਜੰਗ ਆਸਨ ਇਹ ਸਭ ਲਚਕਤਾ ਵਧਾਉਣ 'ਚ ਮਦਦ ਕਰਦੇ ਨੇ ਲੇਕਿਨ ਜੇ ਤੁਸੀਂ ਸਿਰਫ ਇਕ ਆਸਨ ਦੀ ਗੱਲ ਕਰਦੇ ਹੋ ਤਾਂ ਸੂਰਿਆ ਨਮਸਕਾਰ ਤੋਂ ਬੈਸਟ ਕੋਈ ਵੀ ਆਸਨ ਨਹੀਂ ਹੈ ਅਨੋ ਅਲੋਮ ਵਿਲੋਮ ਜੋ ਹੈ ਉਹ ਤੁਹਾਡੇ ਫੇਫੜਿਆਂ ਲਈ ਸਭ ਤੋਂ ਵਧੀਆ